ਹੈਲੋ ਹੈਲੋ ਹਾਂਜੀ ਮੈਮ ਜੱਸ ਕਲੋਥ ਹਾਊਸ ਤੋਂ ਬੋਲ ਰਹੇ ਹੋ ਮੈਮ ਮੈਂ ਨਾ ਦਰਅਸਲ ਸੂਟ ਲੈਣੇ ਸੀ ਮੈਨੂੰ ਐਕਚੁਲੀ ਮੇਰੇ ਬ੍ਰਦਰ ਦੀ ਮੈਰਿਜ ਆ ਰਹੀ ਹੈ ਅਤੇ ਮੈਂ ਸੁਣਿਆ ਕਿ ਇੱਥੇ ਮਤਲਬ ਬਹੁਤ ਵਧੀਆ ਮਿਲਦੇ ਨੇ ਕਾਫੀ

ਹਾਂਜੀ ਮੈਮ ਐਕਚੁਲੀ ਮੈਂ ਨਾ ਕਨਫਿਊਜ ਹਾਂ ਅਤੇ ਮੈਨੂੰ ਥੋੜ੍ਹਾ ਇਹ ਨਹੀਂ ਸਮਝ ਆਉਂਦਾ ਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਗਰਮੀ ਦਾ ਮੌਸਮ ਹੈ ਅਤੇ ਮੈਨੂੰ ਜ਼ਿਆਦਾ ਮਤਲਬ ਇਹੋ ਜਿਹਾ ਕੱਪੜਾ ਨਹੀਂ ਚਾਹੀਦਾ ਜੋ ਹੋਵੇ ਮੈਨੂੰ ਡਿਸੈਂਟ ਲੁੱਕ ਵਿੱਚ ਕੱਪੜਾ ਚਾਹੀਦਾ ਜਿਸ ਨਾਲ ਥੋੜ੍ਹੀ ਸੋਬਰ ਲੁਕ ਆਵੇ ਹਾਂਜੀ ਉਸ ਲਈ ਤੁਸੀਂ ਮੈਨੂੰ ਕੋਈ ਕੱਪੜਾ ਪਹਿਲਾਂ ਸੁਜੈਸਟ ਕਰ ਸਕਦੇ ਹੋ ਲਾਈਕ ਜਿੱਦਾਂ ਕਿ ਕੋਟਨ ਦਾ ਕੱਪੜਾ ਹੈ ਉਹਦੇ ਵਿੱਚ ਜ਼ਿਆਦਾ ਹੀ ਜਿਹੜੀ ਆਪਾਂ ਮਤਲਬ ਜ਼ਿਆਦਾ ਹੀ ਨੋ ਸਿੰਪਲ ਰੇਂਜ ਦੇ ਵਿੱਚ ਆ ਜਾਂਦਾ ਉਹ ਅਤੇ ਸਿੰਪਲ ਹੁੰਦਾ ਹੈ ਹਾਂਜੀ ਹਾਂਜੀ ਹਾਂਜੀ ਪਾਰਟੀ ਵੇਅਰ ਹੋਵੇ

ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਮੈਮ ਇੱਕ ਹਾਨ ਹਾਂਜੀ ਹਾਂਜੀ ਅਤੇ ਮਤਲਬ ਕ ਮੈਨੂੰ ਤਿੰਨ ਦਿਨਾਂ ਦੇ ਫੰਕਸ਼ਨ ਲਈ ਸੂਟ ਚਾਹੀਦੇ ਨੇ ਅਲੱਗ ਅਲੱਗ ਇੱਕ ਰਿਸੈਪਸ਼ਨ ਦੀ ਲੁੱਕ ਲਈ ਅਲੱਗ ਚਾਹੀਦੀ ਹੈ ਅਤੇ ਜਾਗੋ ਲੁੱਕ ਲਈ ਅਲੱਗ ਚਾਹੀਦੇ ਹੈ ਜਾਗੋ ਲੁਕ ਲਈ ਮੈਨੂੰ ਐਵੇਂ ਦੀ ਕੁਛ ਕੱਪੜਾ ਚਾਹੀਦਾ ਜਿਸਦਾ ਕਿ ਮੈਂ ਘੱਗਰਾ ਵੀ ਸਵਾ ਸਕਾਂ ਅਤੇ ਸ਼ੋਟ ਕੁੜਤੀ ਨਾਲ ਉਹਨੂੰ ਪਾ ਸਕਾਂ ਅਤੇ ਉਹ ਥੋੜ੍ਹੀ ਉਸ ਦੇ ਨਾਲ ਮੈਨੂੰ ਫੁਲਕਾਰੀ ਵੀ ਚਾਹੀਦੀ ਹੈ ਕਿਆ ਤੁਹਾਡੇ ਕੋਲ ਫੁਲਕਾਰੀਆਂ ਵੀ ਹਨ ਨਹੀਂ ਨਹੀਂ ਮੈਂ ਖੁਦ ਦਾ ਹੀ ਖਰੀਦਣਾ ਜੀ ਰੈਂਟ 'ਤੇ ਨਹੀਂ ਲੈਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਮ ਮੈਮ ਔਨਲਾਈਨ ਪੇਮੈਂਟ ਵਗੈਰਾ ਹੀ ਹੁੰਦੀ ਹੈ ਜਾਂ ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਹਾਂ ਆਪਾਂ ਅਤੇ ਹੋਮ ਡਿਲੀਵਰੀ ਅਵੇਲੇਬਲ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਜਦੋਂ ਵੀ ਮੈਨੂੰ ਟਾਈਮ ਮਿਲਿਆ ਮੈਂ ਜ਼ਰੂਰ ਆਵਾਂਗੀ ਠੀਕ ਹੈ ਜੀ ਥੈਂਕ ਯੂ